ਸਤਿ ਸ਼੍ਰੀ ਅਕਾਲ ਜੀ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਜਿਵੇਂ ਕਿ ਤੁਸੀਂ ਪੁੱਛਿਆ ਹੈ ਕਿ ਤੁਹਾਡੇ ਰਾਜ ਵਿੱਚ ਆਲੇ ਦੁਆਲੇ ਸ਼ਹਿਰ ਵੀ ਦੇ ਦੁਆਲੇ ਤੁਹਾਨੂੰ ਸਮਾਨ ਕਿਵੇਂ ਪ੍ਰਾਪਤ ਹੁੰਦਾ ਹੈ ਅਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਸਿਰਫ ਇਦੀ ਸ਼ਹਿਰ ਦੇ ਵਿੱਚ ਹੀ ਮਿਲਦੀਆਂ ਹਨ ਅਤੇ ਹੁਣ ਪਿੰਡਾਂ ਵਿੱਚ ਵੀ ਮਿਲਦੀਆਂ ਹਨ ਪਹਿਲਾਂ ਤਾਂ ਸਾਨੂੰ ਹਰ ਚੀਜ਼ ਵਾਸਤੇ ਜਾਂ ਜਿੱਦਾਂ ਕਿ ਕੱਪੜਾ ਹੋ ਗਿਆ ਕੋਈ ਖਾਣ ਦਾ ਸਮਾਨ ਠੀਕ ਹੈ ਜੀ ਹੋਰ ਆਦਿ ਚੀਜ਼ਾਂ ਰਾਸ਼ਨ ਵਗੈਰਾ ਸਾਨੂੰ ਲੈਣ ਲਈ ਸ਼ਹਿਰ ਜਾਣਾ ਪੈਂਦਾ ਸੀ ਲੇਕਿਨ ਹੁਣ ਇਸ ਦੇਸ਼ ਮੇ ਵਿੱਚ ਸਾਨੂੰ ਜੋ ਚੀਜ਼ ਸ਼ਹਿਰ ਵਿੱਚ ਹੈ ਉਹ ਹਰ ਚੀਜ਼ ਸਾਨੂੰ ਆਪਣੇ ਪਿੰਡਾਂ ਵਿੱਚ ਹੀ ਮਿਲਦੀ ਹੈ ਜਿੱਦਾਂ ਕੋਈ ਕੱਪੜਾ ਠੀ ਉਹ ਸਬਜ਼ੀ ਹੋ ਗਈ ਇਹ ਸਾਨੂੰ ਮਤਲਬ ਹਰ ਪਿੰਡ ਪਿੰਡ ਵਿੱਚ ਕੋਈ ਨਾ ਕੋਈ ਦੁਕਾਨ ਮਿਲ ਜਾਂਦੀ ਹੈ ਕਿ ਜਿਸ ਤੋਂ ਅਸੀਂ ਕੱਪੜਾ ਲੈ ਲਈਏ ਹੋਰ ਸਬਜ਼ੀ ਲੈ ਲਈਏ ਜੇ ਖਾ ਬਾਤ ਕਰੀਏ ਅਸੀਂ ਫਾਸਟ ਫੂਡ ਦੀ ਪਹਿਲਾਂ ਤਾਂ ਸ਼ਹਿਰ ਵਿੱਚ ਹੀ ਮਿਲਦਾ ਸੀ ਲੇਕਿਨ ਹੁਣ ਤਾਂ ਹਰ ਪਿੰਜ ਦੇ ਪਿੰਜ ਦੇ ਪਿੰਡ ਦੇ ਚੁਰਾਹੇ ਵਿੱਚ ਇਹ ਦੁਕਾਨ ਜਾਂ ਰੇਹੜੀ ਮਿਲ ਜਾਂਦੀ ਹੈ ਅਤੇ ਪਹਿਲਾਂ ਤਾਂ ਸਾਨੂੰ ਕੋਈ ਵੀ ਚੀਜ਼ ਲੈਣ ਲਈ ਸ਼ਹਿਰ ਜਾਣਾ ਪੈਂਦਾ ਸੀ ਲੇਕਿਨ ਹੁਣ ਤਾਂ ਸਾਡਾ ਬਹੁਤ ਹੀ ਟਾਈਮ ਬਚ ਜਾਂਦਾ ਹੈ ਪਹਿਲਾਂ ਸਾਨੂੰ ਹਰ ਚੀਜ਼ ਸ਼ਹਿਰ ਲੈਣ ਲਈ ਜਾਣਾ ਪੈਂਦਾ ਸੀ ਤਾਂ ਦੂਰ ਜਾਣਾ ਪੈਂਦਾ ਸੀ ਲੇਕਿਨ ਹੁਣ ਤਾਂ ਘਰੋਂ ਬਾਹਰ ਨਿਕਲੋ ਤਾਂ ਹਰ ਚੀਜ਼ ਮਿਲ ਜਾਂਦੀ ਹੈ ਜੋ ਕਿ ਮੂੰਹ ਦੇ ਵਿੱਚ ਕੱਢੋ ਉਹ ਚੀਜ਼ ਸਾਨੂੰ ਘਰ ਪਿੰਡ ਵਿੱਚ ਹੀ ਮਿਲ ਜਾਂਦੀ ਹੈ ਲੇਕਿਨ ਹੁਣ ਪਿੰਡ ਅਤੇ ਸ਼ਹਿਰ ਵਿੱਚ ਕੋਈ ਫਰਕ ਨਹੀਂ ਰਿਹਾ ਇਸ ਲਈ ਸਾਨੂੰ ਪਿੰਡ ਵਿੱਚ ਹਰ ਚੀਜ਼ ਮਿਲ ਜਾਂਦੀ ਹੈ